ਪੰਦਰ੍ਹਾਂ ਅਗਸਤ ਉੱਨੀ ਸੌ ਸੰਤਾਲੀ ਛੱਬੀ ਜਨਵਰੀ ਉੱਨੀ ਸੌ ਪੰਜਾਹ ਤਿੰਨ ਮਈ ਉੱਨੀ ਸੌ ਨੱਬੇ ਦੋ ਫਰਵਰੀ ਦੋ ਹਜ਼ਾਰ ਸੱਤ ਛੱਬੀ ਸਤੰਬਰ ਦੋ ਹਜ਼ਾਰ ਤਿੰਨ